ਹੈਲੋ ਜੀ ਹਾਂਜੀ ਹਾਂਜੀ ਸਿੰਘ ਸਟੂਡੀਓ ਤੋਂ ਗੱਲ ਕਰ ਰਿਹਾ ਬਠਿੰਡਾ ਤੋਂ ਜੀ ਹਾਂਜੀ ਹਾਂਜੀ ਵੀਰੇ ਅੱਛਾ ਅੱਛਾ ਜੀ ਹਾਂਜੀ ਹਾਂਜੀ ਦੱਸੋ ਜੀ ਕਿਹੜੀ ਡੇਟ ਦਾ ਪ੍ਰੋਗਰਾਮ ਆ ਜੀ ਉੱਨੀ ਜੂਨ ਦੋ ਹਜ਼ਾਰ ਚੌਵੀ ਅੱਛਾ ਠੀਕ ਆ ਜੀ ਵੈਸੇ ਤਾਂ ਸਾਡੇ ਕੋਲ ਇਹਨਾਂ ਡੇਟਾਂ ਦੇ ਵਿੱਚ ਫੰਕਸ਼ਨ ਹੈਗਾ ਬੁੱਕ ਜੀ ਪਰ ਕੋਈ ਗੱਲ ਨਹੀਂ ਅਸੀਂ ਤੁਹਾਡਾ ਪ੍ਰੋਗਰਾਮ ਅਟੈਂਡ ਕਰਾਂਗੇ ਜ਼ਰੂਰ ਅਤੇ ਕੋਈ ਗੱਲ ਨਹੀਂ ਤੁਸੀਂ ਦੱਸੋ ਕਿ ਕੀ ਕਰਵਾਉਣਾ ਵੀਡੀਓਗ੍ਰਾਫੀ ਫੋਟੋਗ੍ਰਾਫੀ ਦੋਨੋਂ ਸੂਟ ਕਰਵਾਉਣੀ ਆ ਜਾਂ ਸਿੰਗਲ ਵੀਡੀਓਗ੍ਰਾਫੀ ਅੱਛਾ ਦੋਨਾਂ ਦਾ ਵੈਸੇ ਤਾਂ ਸੀਜ਼ਨ ਦੇ ਅਕੋਰਡਿੰਗ ਚੱਲ ਰਿਹਾ ਜੀ ਬੱਤੀ ਹਜ਼ਾਰ ਰੁਪਿਆ ਪਰ ਪਰ ਫੰਕਸ਼ਨ ਦਾ ਅਤੇ ਬਾਕੀ ਕੋਈ ਗੱਲ ਨਹੀਂ ਜਿਹੜਾ ਤੁਹਾਡਾ ਵੀਡੀਓਗ੍ਰਾਫੀ ਟੈਮ ਦੇ ਨਾਲ ਅਤੇ ਤੁਹਾਡੀ ਕੋਈ ਫੋਟੋ ਸੂਟ ਦੇ ਨਾਲ ਕਿੰਨੀ ਫੋਟੋ ਰੱਖਣਾ ਚਾਹੁੰਦੇ ਹੋ ਐਲਬਮ ਦੇ ਅਕੋਰਡਿੰਗ ਉਹ ਤਾਂ ਕੋਈ ਨਹੀਂ ਅਸੀਂ ਵੀ ਰਿਆਇਤ ਕਰ ਦੇਵਾਂਗੇ ਰੇਟ ਇਹੀ ਹੈ ਜੀ ਪੰਜ ਹਜ਼ਾਰ ਘੰਟੇ ਦੇ ਹਿਸਾਬ ਨਾਲ ਪਰ ਘੰਟਾ ਠੀਕ ਆ ਤੁਹਾਨੂੰ ਚਲੋ ਪੰਤਾਲੀ ਸੌ ਦੇ ਹਿਸਾਬ ਨਾਲ ਤਿੰਨ ਘੰਟਿਆਂ ਦੀ ਵੀਡੀਓ ਦੇਵਾਂਗੇ ਅਤੇ ਢਾਈ ਸੌ ਫੋਟੋ ਲੱਗੇਗੀ ਐਲਬਮ ਦੇ ਵਿੱਚ ਵਧੀਆ ਕੁਆਲਿਟੀ ਦੀ ਫੋਟੋਗ੍ਰਾਫੀ ਮਿਲੇਗੀ ਹਾਂਜੀ ਅਤੇ ਬਾਕੀ ਕੋਈ ਹੋਰ ਸੇਵਾ ਉਹ ਵੀ ਦੱਸਾਂਗੇ ਤੁਹਾਨੂੰ ਰਿਆਇਤ ਕੋਈ ਗੱਲ ਨਹੀਂ ਜੀ ਵੈਸੇ ਅਸੀਂ ਆਪਣਾ ਪੈਂਤ ਬੱਤੀ ਹਜ਼ਾਰ ਦੱਸਿਆ ਤੁਹਾਨੂੰ ਅਤੇ ਕੋਈ ਗੱਲ ਨਹੀਂ ਫੰਕਸ਼ਨ ਤੋਂ ਬਾਅਦ ਬਾਕੀ ਜੇ ਵਧੀਆ ਆਪਣਾ ਫੰਕਸ਼ਨ ਹੋ ਜਾਂਦਾ ਤਾਂ ਤੁਹਾਨੂੰ ਸਤਾਈ ਅਠਾਈ ਦੇ ਲਗਭਗ ਕਰ ਦੇਵਾਂਗੇ ਠੀਕ ਆ ਜੀ ਹਾਂਜੀ ਅਤੇ ਵਧੀਆ ਫੋਟੋਗ੍ਰਾਫੀ ਦੀ ਪੂਰੀ ਵਧੀਆ ਕੁਆਲਿਟੀ ਮਿਲੇਗੀ ਕੋਈ ਦਿੱਕਤ ਨਹੀਂ ਆਏਗੀ ਓਦਾਂ ਦੀ ਠੀਕ ਆ ਵੀਰ ਜੀ ਹਾਂਜੀ ਹੋਰ ਦੱਸੋ ਕੀ ਸੇਵਾ ਕਰ ਸਕਦੇ ਹਾਂ ਜੀ ਤੁਹਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੰਕਸ਼ਨ ਦੇ ਅਕੋਰਡਿੰਗ ਸਾਨੂੰ ਤੁਸੀਂ ਇੱਕ ਵਾਰੀ ਲਿਖ ਦਿਓ ਅਤੇ ਵੇਰਵਾ ਦੇ ਦਿਓ ਨਾ ਕਿਹੜੀ ਡੇਟ ਦਾ ਹੈ ਤਾਂ ਤੁਹਾਡਾ ਕਰਵਾ ਦੇਵਾਂਗੇ ਫੰਕਸ਼ਨ ਕੰਪਲੀਟ ਓਕੇ ਜੀ ਓਕੇ ਓਕੇ ਜੀ ਥੈਂਕਯੂ